ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੈਂਥ ਟੇਲਰ ਬਰਨਾਲਾ ਤੋਂ ਬੋਲਦੇ ਹੋ ਹਾਂਜੀ ਸਾਡੇ ਨਾ ਜੀ ਘਰ ਵਿਆਹ ਦਾ ਪ੍ਰੋਗਰਾਮ ਸੀ ਅਤੇ ਜੀ ਵੀ ਵਾਹਵਾ ਸਾਰੇ ਕੁੜਤੇ ਪਜਾਮੇ ਸਿਲੋਣੇ ਸੀਗੇ ਦਸ ਬਾਰ੍ਹਾਂ ਅਤੇ ਹਾਂਜੀ ਉਹਦਾ ਵੀ ਹਿਸਾਬ ਕਿਤਾਬ ਦੱਸ ਦਿੰਦੇ ਵੀ ਕਿਵੇਂ ਵੀ ਜਿਹੜੇ ਨਵੇਂ ਟਰੈਂਡ ਦੇ ਚੱਲੇ ਆ ਪਠਾਣੀ ਕੁੜਤੇ ਪਜਾਮੇ ਹੋ ਗਏ ਵੈਲ ਬੋਟਮ ਹੋ ਗਏ ਹਾਂਜੀ ਉਹਨੇ ਸਮਾਈ ਦੱਸ ਦਿੰਦੇ ਇੱਕ ਵਾਰੀ ਵੀ ਕਿਵੇਂ ਕਿਵੇਂ ਆ ਪ੍ਰੋਗਰਾਮ ਤਾਂ ਜੀ ਅਜੇ ਤਿੰਨ ਕੁ ਮਹੀਨਿਆਂ ਨੂੰ ਆ ਅਸੀਂ ਦਸ ਬਾਰ੍ਹਾਂ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਕੁਰਸੀ ਉਹ ਵੀ ਸਮ ਸਵਾਉਣੇ ਆ ਜੀ ਪਹਿਲਾਂ ਕੁੜਤੇ ਪਜਾਮੇ ਦਾ ਜੀ ਕਲੀਅਰ ਕਰ ਦਿਓ ਵੀ ਇਹ 'ਚ ਕੱਪੜੇ ਕੱਪੜੇ ਵੀ ਕਿਹੜਾ ਕਿਹੜਾ ਅਵੇਲੇਬਲ ਹੋਵੇਗਾ ਵੀ ਕਿਹੜੇ ਬ੍ਰਾਂਡ ਦੇ ਹੋਣਗੇ ਕੱਪੜਾ ਵੀ ਉਹਨਾਂ ਨੇ ਜਿਹੜਾ ਅੱਛਾ ਜੀ ਅਤੇ ਪੈਂਟ ਕੋਟ ਜੀ ਜੀ ਰੀਮੰਡ ਉਹ ਤਾਂ ਆਵਾਂਗੇ ਜੀ ਤੁਸੀਂ ਐਂ ਦੱਸੋ ਵੀ ਰੇਮੰਡ ਦੇ ਹੋ ਜਾਣਗੇ ਪੈਂਟ ਕੋਟ ਵੀ ਵੈਲ ਵੋਟਮ ਸ ਸਿਉਂ ਦੋਗੇ ਤੁਸੀਂ ਹਾਂਜੀ ਹਾਂਜੀ ਹਾਂਜੀ ਅ ਅਰਜਨ

ਹਾਂਜੀ ਹਾਂਜੀ ਅੰਕਲ ਤੁਸੀਂ ਐਂ ਵੀ ਦੱਸ ਦਿੰਦੇ ਜੀ ਕੋਈ ਜੁੱਤੀਆਂ ਵਾਲੀ ਘੈਂਟ ਦੀ ਦੁਕਾਨ ਵੀ ਬੈਲੀਆਂ ਬੁਲੀਆਂ ਸਸਤੇ ਰੇਟ 'ਚ ਵਧੀਆ ਮਿਲ ਜਾਣ ਅੰਕਲ ਅੰਕਲ ਖੜ੍ਹੇ ਓਂ ਜੀ ਅੰਕਲ ਜੀ ਬਸ ਜੀ ਲੱਗ ਗਿਆ ਹਿਸਾਬ ਕਿਤਾਬ ਪਤਾ ਧੰਨਵਾਦ ਜੀ ਆਉਣੇ ਹਾਂ ਮਾਰਦੇ ਹਾਂ ਪਰਸੋਂ ਚੌਥੇ ਤੱਕ ਗੇੜਾ ਦੁਕਾਨ 'ਤੇ ਠੀਕ ਹੈ ਜੀ